ਮੈਂ ਪੰਜਾਬ ਦੇ ਵਿੱਚ ਰਹਿਨੀ ਹਾਂ ਮੇਰੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਬਹੁਤ ਹੀ ਜਿੰਮੇਵਾਰ ਨੇ ਤੇ ਉਹਨਾਂ ਨੇ ਬਹੁਤ ਸਾਰੇ ਜਾਨਵਰ ਵਗੈਰਾ ਜਿਹੜੇ ਰੱਖਦੇ ਨੇ ਉਹ ਪਸ਼ੂ ਵਗੈਰਾ ਵੀ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਵੀ ਸਾਡੇ ਪਸ਼ੂ ਜਿਹੜੇ ਨੇ ਉਹ ਆਪਣੇ ਪਸ਼ੂਆਂ ਨੂੰ ਬੱਚਿਆਂ ਵਾਂਗੂੰ ਪਾਲਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਸ਼ੂ ਜਿਹੜੇ ਨੇ ਜਾਨਵਰ ਜਿਹੜੇ ਨੇ ਉਹ ਤੰਦਰੁਸਤ ਰਹਿਣ ਤੇ ਰੋਗਾਂ ਤੋਂ ਮੁਕਤ ਰਹਿਣ ਤੇ ਉਹ ਹਮੇਸ਼ਾ ਉਹਨਾਂ ਨੂੰ ਸਮੇਂ ਸਮੇਂ ਤੇ ਡਾਕਟਰ ਦੇ ਕੋਲੋਂ ਉਹਨਾਂ ਦੀ ਮਤਲਬ ਜਾਂਚ ਵੀ ਕਰਵਾਉਂਦੇ ਨੇ ਉਹਨਾਂ ਦੀ ਸਿਹਤ ਦੀ ਤੇ ਉਹਨਾਂ ਦਾ ਟੀਕਾਕਰਨ ਵਗੈਰਾ ਵੀ ਸਮੇਂ ਸਮੇਂ ਤੇ ਕਰਾਂਦੇ ਨੇ ਤੇ ਤਾਂ ਕਿ ਉਹਨਾਂ ਨੂੰ ਕੋਈ ਵੀ ਰੋਗ ਨਾ ਹੋ ਸਕੇ ਤੇ ਇਸ ਕਰਕੇ ਸਾਨੂੰ ਪੂਰੀ ਤਰਹਾਂ ਦੇ ਨਾਲ ਆਪਣੇ ਜਾਨਵਰਾਂ ਦਾ ਧਿਆਨ ਰੱਖਦੇ ਨੇ ਉਹਨਾਂ ਨੂੰ ਨਵਾਉਂਦੇ ਨੇ ਧਵਾਂਦੇ ਨੇ ਉਹਨਾਂ ਦੀ ਖੁਰਾਕ ਜਿਹੜੀ ਉਹ ਬਹੁਤ ਵਧੀਆ ਖੁਰਾਕ ਪਾਂਦੇ ਨੇ ਕੀ ਤਾਂ ਕਿ ਉਹ ਖਰਾਬ ਖਾਣ ਦੇ ਨਾਲ ਮਤਲਬ ਵਧੀਆ ਖੁਰਾਕ ਖਾਣ ਤੇ ਵਧੀਆ ਸਾਨੂੰ ਦੁੱਧ ਵੀ ਦੇਣ ਜਾਨਵਰ ਹਨਾ ਤੇ ਤਾਂ ਕਿ ਸਾਰੇ ਜਿਹੜੇ ਵੀ ਉਹਨਾਂ ਨੂੰ ਪੀਣ ਉਹ ਵੀ ਤੰਦਰੁਸਤ ਰਹਿਣ ਤੇ ਇਸ ਕਰਕੇ ਉਹਨਾਂ ਦੀ ਉਹਨਾਂ ਦਾ ਟੀਕਾਕਰਨ ਵੀ ਕਰਾਉਂਦੇ ਨੇ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਆ ਜਾਂਦੀਆਂ ਨੇ ਜਿਵੇਂ ਮੂੰਹ ਖੁਰ ਦੀ ਬਿਮਾਰੀ ਡੀਫੋਰਮਿੰਗ ਦੀ ਰੈਬਿਕਸ ਵਗੈਰਾ ਤੇ ਇਹੋ ਜਿਹੀਆਂ ਜਾਨਵਰਾਂ ਨੂੰ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਉਹ ਡਾਕਟਰ ਕੋਲ ਜਾ ਕੇ ਉਹਨਾਂ ਦਾ ਪੂਰੀ ਪੂਰੀ ਤਰ੍ਹਾਂ ਦੇ ਨਾਲ ਉਹਦਾ ਇਲਾਜ ਵੀ ਕਰਾਉਂਦੇ ਨੇ ਇਸ ਕਰਕੇ ਕਿਸਾਨਾਂ ਨੂੰ ਵੀ ਚਾਹੀਦਾ ਵੀ ਉਹ ਪੂਰੀ ਤਰਹਾਂ ਦੇ ਨਾਲ ਆਪਣੇ ਜਾਨਵਰਾਂ ਦਾ ਟਾਈਮ ਦੇ ਨਾਲ ਉਹਨਾਂ ਨੂੰ ਟੀਕਾਕਰਨ ਕਰਾਉਂਦੇ ਰਹਿਣ ਤੇ ਤੇ ਤਾਂ ਕਿ ਉਹ ਮਨੁੱਖਾਂ ਨੂੰ ਪ੍ਰਭਾਵਿਤ ਇਹਦੇ ਨਾਲ ਮਨੁੱਖ ਪ੍ਰਭਾਵਿਤ ਨਾ ਹੋਣ ਤੋਂ ਕਿ ਜਿਹੜੇ ਜਾਨਵਰ ਠੀਕ ਹੋਣਗੇ ਇਹ ਮਨੁੱਖ ਵੀ ਉਹਦੇ ਨਾਲ ਰੋਗਾਂ ਤੋਂ ਮੁਕਤ ਹੋਣਗੇ